ਪੰਜਾਬ ਦੇ ਸਕੂਲਾਂ ਵਿੱਚ ਫੀਸ ਬਹੁਤ ਜ਼ਿਆਦਾ ਹੈ ਜਿਸ ਕਰਕੇ ਮੈਂ ਪਹਿਲਾਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਲਗਾਇਆ ਸੀ ਪਰ ਸਰਕਾਰੀ ਸਕੂਲ ਵਿੱਚ ਅਧਿਆਪਕਾਂ ਦੀ ਗਿਣਤੀ ਪੂਰੀ ਨਾ ਹੋਣ ਕਰਕੇ ਮੈਨੂੰ ਜਵਾਕਾਂ ਨੂੰ ਉੱਥੋਂ ਹਟਾਉਣਾ ਪੈ ਗਿਆ ਹੁਣ ਫਿਰ ਤੋਂ ਜਵਾਕਾਂ ਨੂੰ ਪ੍ਰਾਈਵੇਟ ਸਕੂਲ ਵਿੱਚ ਲਗਾਉਣਾ ਪੈ ਗਿਆ ਜਿਸ ਸਕੂਲ ਵਿੱਚ ਹੁਣ ਜਵਾਕ ਪੜ੍ਹਾਈ ਕਰਦੇ ਹਨ ਉਸ ਸਕੂਲ ਵਿੱਚ ਫੀਸ ਬਹੁਤ ਜ਼ਿਆਦਾ ਹੈ ਕਈ ਪੜ੍ਹਾਈ ਦੀ ਫੀਸ ਸਕੂਲ ਦੀ ਫੀਸ ਸਕਿਊਰਟੀ ਫੀਸ ਟੂਰਾਂ ਦੀ ਫੀਸ ਅਤੇ ਹੋਰ ਵੀ ਕਈ ਫੀਸਾਂ ਆਦਿ ਕਰਨੀਆਂ ਪੈਂਦੀਆਂ ਹਨ ਅਦਾ ਕਰਨੀਆਂ ਪੈਂਦੀਆਂ ਹਨ